ਗੱਲ ਕਰੀਏ ਟਿਊਬ ਵੈਲ ਦੀ ਤਾਂ ਪਿੰਡਾਂ ਦੇ ਵਿੱਚ ਜ਼ਿਆਦਾ ਕਰਕੇ ਟਿਊਬ ਵੈਲ ਹੀ ਕੰਮ ਆਉਂਦੇ ਸਿੰਚਾਈ ਦਾ ਸਾਧਨ ਇਹੀ ਕਾਰਨ ਹੈ ਅਤੇ ਇਹ ਕੰਮ ਕਿੱਦਾਂ ਕਰਦਾ ਮੈਂ ਤੁਹਾਨੂੰ ਇਹ ਦੱਸਦਾ ਮੇਨਲੀ ਪਹਿਲਾਂ ਧਰਤੀ ਦੇ ਵਿੱਚ ਪਾਈਪਾਂ ਰਾਹੀਂ ਬੋਰ ਕੀਤਾ ਜਾਂਦਾ ਹੈ ਧਰਤੀ ਵਿੱਚੋਂ ਪਾਣੀ ਕੱਢਿਆ ਜਾਂਦਾ ਹੈ ਫ਼ਿਰ ਉਸ ਦੇ ਵਿੱਚ ਪਲਾਸਟਿਕ ਦੀਆਂ ਪਾਈਪਾਂ ਧਰਤੀ ਦੇ ਵਿੱਚ ਉਤਾਰੀਆਂ ਜਾਂਦੀਆਂ ਨੇ ਫਿਰ ਉਸ ਦੇ ਵਿੱਚ ਸਮਬਰਸੀਬਲ ਮੋਟਰ ਹੁੰਦੀ ਹੈ ਜੋ ਕਿ ਧਰਤੀ ਦੇ ਵਿੱਚ ਉਤਾਰੀ ਜਾਂਦੀ ਹੈ ਅਤੇ ਉਹ ਪਾਇਪਾਂ ਰਾਹੀਂ ਪਾਣੀ ਬਾਹਰ ਕੱਢਿਆ ਜਾਂਦਾ ਹੈ ਫਿਰ ਇੱਕ ਉਹ ਪਾਣੀ ਨੂੰ ਸਿਟਣ ਦੇ ਲਈ ਇੱਕ ਚਵਚਾ ਤਿਆਰ ਕੀਤਾ ਜਾਂਦਾ ਹੈ ਅਤੇ ਗੱਲ ਕਰੀਏ ਪਿੰਡਾਂ ਦੇ ਵਿੱਚ ਕੁਝ ਸਾਡੇ ਪਿੰਡ ਦੇ ਵਿੱਚ ਮੋਸਟਲੀ ਇੱਕ ਖੂਹ ਹੈ ਜੋ ਕਿ ਬਹੁਤ ਘੱਟ ਲੋਕ ਉਸ ਨੂੰ ਵਰਤਦੇ ਨੇ ਕਿਉਂਕਿ ਅੱਗੇ ਅੱਗੇ ਖੂਹ ਖਤਮ ਹੁੰਦੇ ਜਾ